ਮੇਰੀ ਫੋਟੋਗ੍ਰਾਫੀ ਬਹੁਤ ਹੀ ਨਾ ਧਿਆਨ ਦੇਣ ਵਾਲੀਆਂ ਚੀਜ਼ਾਂ 'ਤੇ ਹੁੰਦੀ ਹੈ ਕਲਾ ਅੱਜ ਕੱਲ੍ਹ ਲੋਕ ਜ਼ਿਆਦਾ ਧਿਆਨ ਨਹੀਂ ਦਿੰਦੇ ਉਹਨਾਂ ਚੀਜ਼ਾਂ ਉੱਤੇ ਧਿਆਨ ਦੇ ਕੇ ਮੈਂ ਫੋਟੋਗ੍ਰਾਫੀ ਕਰਦਾ ਹਾਂ ਜਿਵੇਂ ਕਿ ਆਸ ਪਾਸ ਦਾ ਪ੍ਰਗਤੀ ਜਿਵੇਂ ਕਿ ਹੁਣ ਪੇੜ 'ਤੇ ਬੈਠੇ ਘੋਸਲੇ 'ਤੇ ਜ਼ਿਆਦਾਤਰ ਲੋਕ ਇਗਨੋਰ ਮਾਰ ਕੇ ਅੱਗੇ ਚਲ ਜਾਂਦੇ ਆ ਉਹਨਾਂ ਚੀਜ਼ਾਂ ਦੀ ਫੋਟੋ ਖਿੱਚਦਾ ਹਾਂ ਅਤੇ ਇਹ ਮੇਰੀ ਸੋਚ ਨੂੰ ਅਲੱਗ ਤਰ੍ਹਾਂ ਤੋਂ ਸੋਚਣ ਨੂੰ ਜ਼ੋਰ ਪਾਉਂਦੀ ਹੈ ਇਹ ਬਹੁਤ ਹੀ ਇੱਕ ਅਲੱਗ ਤਰੀਕੇ ਦੀ ਫੋਟੋਗ੍ਰਾਫੀ ਹੁੰਦੀ ਹੈ ਜੋ ਕਿ ਬਹੁਤ ਹੀ ਸੋਹਣੀ ਲੱਗਦੀ ਹੈ ਇਹ ਫੋਟੋਗ੍ਰਾਫੀ ਮੈਨੂੰ ਬਚਪਨ ਤੋਂ ਸ਼ੌਕ ਸੀ ਅਤੇ ਹਾਲੇ ਤੱਕ ਮੈਂ ਇਹ ਫੋਟੋਗ੍ਰਾਫੀ ਦੇ ਸ਼ੌਕ ਨੂੰ ਫੋਲੋ ਕਰਦਾ ਆ ਰਿਹਾ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਬਹੁਤ ਵਧੀਆ ਫੋਟੋਗ੍ਰਾਫੀ ਕਰ ਪਾਉਂਦਾ ਹਾਂ